ਜਦੋਂ ਕਿਸੇ ਆਦਮੀ ਜਾਂ ਔਰਤ ਦੀ ਮੌਤ ਹੁੰਦੀ ਹੈ ਤਦ ਸਭ ਤੋਂ ਪਹਿਲਾਂ ਸਾਰੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਹਨ ਅਤੇ ਇੱਕ ਦੂਸਰੇ ਨੂੰ ਹੌਂਸਲਾ ਦਿੰਦੇ ਹਨ ਮ੍ਰਿਤਕ ਦੇਹ ਨੂੰ ਨਵਾਇਆ ਜਾਂਦਾ ਹੈ ਅਤੇ ਜੇ ਕੋਈ ਔਰਤ ਹੋਵੇ ਉਸ ਦੇ ਪੇਕਿਆਂ ਦੁਆਰਾ ਕਫ਼ਨ ਪਾਇਆ ਜਾਂਦਾ ਹੈ ਜੇ ਕੋਈ ਮੁੰਡਾ ਜਵਾਨ ਹੋਵੇ ਤਾਂ ਸਹਿਰਾ ਬੰਦੀ ਦੀ ਰਸਮ ਕੀਤੀ ਜਾਂਦੀ ਹੈ ਅਤੇ ਜੇ ਕੋਈ ਕੁੜੀ ਜਵਾਨ ਹੋਵੇ ਤਾਂ ਉਸਨੂੰ ਫੁਲਕਾਰੀ ਨਾਲ ਸਜਾਇਆ ਜਾਂਦਾ ਹੈ ਅਤੇ ਉਸ ਦਾ ਸ਼ਿੰਗਾਰ ਕੀਤਾ ਜਾਂਦਾ ਹੈ ਬਜ਼ੁਰਗ ਦੇ ਮਰਨ 'ਤੇ ਉਸ ਦੀ ਦੇਹ ਨੂੰ ਗੁਬਾਰਿਆਂ ਨਾਲ ਸਜਾਇਆ ਜਾਂਦਾ ਫਿਰ ਸ਼ਮਸ਼ਾਨ ਭੂਮੀ ਵਿੱਚ ਲੱਕੜੀਆਂ ਰੱਖ ਲੱਕੜੀਆਂ ਦਾ ਬਿਸਤਰਾ ਬਣਾ ਕੇ ਉਸ ਵਿੱਚ ਮ੍ਰਿਤਕ ਦੀ ਦੇਹ ਰੱਖੀ ਜਾਂਦੀ ਹੈ ਅਤੇ ਉਸ ਲੱਕੜੀਆਂ ਨੂੰ ਕਿਸੇ ਰਿਸ਼ਤੇਦਾਰ ਦੁਆਰਾ ਅੱਗ ਲਾਈ ਜਾਂਦੀ ਹੈ ਅਤੇ ਮ੍ਰਿਤਕ ਦੀ ਦੇਹ 'ਤੇ ਦੇਸੀ ਘਿਓ ਲਾਇਆ ਜਾਂਦਾ ਤਾਂ ਕਿ ਦੇਹ ਚੰਗੀ ਤਰ੍ਹਾਂ ਸੜ ਜਾਵੇ ਅਤੇ ਉਸ ਤੋਂ ਬਾਅਦ ਮੂੰਗਫਲੀਆਂ ਵੰਡੀਆਂ ਜਾਂਦੀਆਂ ਹਨ ਅਤੇ ਉਸ ਤੋਂ ਇੱਕ ਦਿਨ ਬਾਅਦ ਫੁੱਲ ਚੁੱਗ ਚੁਗੇ ਜਾਂਦੇ ਹਨ ਅਤੇ ਨੌਂ ਦਿਨ ਬਾਅਦ ਭੋਗ ਪਾਇਆ ਜਾਂਦਾ ਹੈ